ਵੈਸੇ ਤਾਂ ਅਗਰ ਗੱਲ ਕੀਤੀ ਜਾਵੇ ਤਾਂ ਆਪਣੇ ਸਥਾਨ ਦੇ ਵਿੱਚ ਬਹੁਤ ਹੀ ਨੇੜੇ ਨੇੜੇ ਆਪਣੇ ਬਹੁਤ ਹੀ ਇਹੋ ਜਿਹੇ ਕਲਾਕਾਰ ਸਮੁੱਚੇ ਕਲਾਕਾਰ ਹਨ ਜਿਨ੍ਹਾਂ ਨੇ ਧਾਰਮਿਕ ਗੀਤ ਗਾਏ ਹਨ ਆਪਾਂ ਅੱਜ ਗੱਲ ਕਰਾਂਗੇ ਦੋ ਕਲਾਕਾਰ ਦੇ ਬਾਰੇ ਇੱਕ ਕਨਵਰ ਗਰੇਵਾਲ ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ਼ ਹੀ ਬਹੁਤ ਹੀ ਆਵਾਜ਼ ਦੇ ਵਿੱਚ ਬਹੁਤ ਵਧੀਆ ਵਧੀਆ ਧਾਰਮਿਕ ਗਾਣੇ ਗਾਏ ਹਨ ਦੂਜੀ ਗੱਲ ਆਪਾਂ ਕਰਾਂਗੇ ਪੰਮਾ ਡੂਮੇਵਾਲੀਆ ਬਾਰੇ ਜੋ ਕਿ ਸਿੱਧਾ ਉਹਨਾਂ ਦੀ ਆਵਾਜ਼ ਦਿਲ ਨੂੰ ਛੂਹਦੀ ਹੈ ਆਵਾਜ਼ ਉਹਨਾਂ ਦੀ ਬਹੁਤ ਹੀ ਮਿੱਠੀ ਅਤੇ ਸੁਰੀਲੀ ਆਵਾਜ਼ ਹੈ ਜਿਹਦੇ ਨਾਲ ਉਹ ਜਦੋਂ ਗਾਣਾ ਗਾਉਂਦੇ ਹਨ ਤਾਂ ਉਹਨਾਂ ਦੀ ਆਵਾਜ਼ ਬਹੁਤ ਹੀ ਦਿਲ ਨੂੰ ਬਹੁਤ ਹੀ ਪਿਆਰੀ ਲੱਗਦੀ ਹੈ ਅਤੇ ਇਹ ਕਨਵਰ ਗਰੇਵਾਲ ਅਤੇ ਪੰਮਾ ਡੂਮੇਵਾਲੀਆ ਇਹ ਆਪਣੇ ਜ਼ਿਆਦਾਤਰ ਆਪਾਂ ਗੱਲ ਕੀਤੀ ਜਾਵੇ ਕਿ ਆਪਣਾ ਜਿਹੜਾ ਧਾਰਮਿਕ ਕਲਾਕਾਰ ਇਹ ਹਨ ਸਥਾਨਕ ਧਾਰਮਿਕ ਕਲਾਕਾਰ ਇਹ ਆਪਣੇ ਸੱਭਿਆਚਾਰ ਨੂੰ ਸੱਭਿਆਚਾਰਿਕ ਗੀਤ ਗਾਉਂਦੇ ਹਨ ਧਾਰਮਿਕ ਗੀਤ ਗਾਉਂਦੇ ਹਨ ਅਤੇ ਇਹ ਆਪਣੇ ਉਜਾਗਰ ਕਰਦੇ ਹਨ ਇਹ ਆਪਣੇ ਸਥਾਨਕ ਵਾਸੀਆਂ ਨੂੰ ਉਜਾਗਰ ਕਰਦੇ ਹਨ ਤਾਂ ਕਿ ਜੋ ਅਸੀਂ ਵੀ ਅੱਜ ਦੇ ਟਾਈਮ ਜੋ ਹੋਰ ਸਾਈਡ ਆਪਾਂ ਅਦਰ ਸਾਈਡ ਜਾ ਰਹੇ ਹਾਂ ਆਪਾਂ ਵੀ ਧਾਰਮਿਕ ਧਿਆਨ ਦਈਏ